ਬੱਚਿਆਂ ਦਾ ਬੱਚਤ ਖਾਤਾ ਬਣਾਉਣ ਲਈ ਬੱਚਿਆਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ ਕਿਉਂਕਿ ਜਦੋਂ ਬੱਚੇ ਛੋਟੇ ਹੁੰਦੇ ਆ ਲੇਕਿਨ ਜਿਹੜਾ ਪੋਕਿਟ ਖਰਚਾ ਉਹਨਾਂ ਨੂੰ ਮਿਲਦਾ ਹੈ ਉਹ ਪੋਕਿਟ ਖਰਚਾ ਆਪ ਖਰਚਣ ਦੀ ਬਜਾਏ ਉਸ ਨੂੰ ਆਪਣੇ ਬਚਤ ਖਾਤੇ ਵਿੱਚ ਜਮ੍ਹਾਂ ਕਰਵਾਉਣ ਤਾਂ ਜੋ ਜਦੋਂ ਉਹ ਬੱਚੇ ਵੱਡੇ ਹੋਣ ਆਪਣੀ ਹਾਇਰ ਸਟਡੀ ਲਈ ਅਗਲੇਰੀ ਵੱਡੀ ਪੜ੍ਹਾਈ ਲਈ ਕਿ ਥੋੜ੍ਹਾ ਬਹੁਤਾ ਉਹ ਪੈਸਾ ਆਪਣੇ ਖਾਤਿਆਂ ਵਿੱਚ ਜਮ੍ਹਾਂ ਕਰਵਾ ਸਕਣ ਕਿਉਂਕਿ ਸਕੂਲ ਦੇ ਬਾਰ੍ਹਾਂ ਸਾਲ ਹੁੰਦੇ ਹੈ ਲਗਭਗ ਚਲੋ ਚੌਥੀ ਕਲਾਸ ਦੇ ਵਿੱਚ ਬੱਚੇ ਨੂੰ ਇੰਨੀ ਕੁ ਮਚਿਓਰ ਹੋ ਜਾਂਦਾ ਬੱਚਾ ਕਿ ਪੈਸੇ ਉਹ ਜੋੜ ਸਕਦਾ ਆਪਣੇ ਆਪਣੇ ਬਚਤ ਖਾਤੇ ਵਿੱਚ ਜਮ੍ਹਾਂ ਕਰਵਾ ਸਕਦਾ ਹੈ ਤਾਂ ਜਿਵੇਂ ਜਿਵੇਂ ਉਹ ਵੱਡਾ ਹੋਏਗਾ ਜਿਵੇਂ ਜਿਵੇਂ ਉਹਦੇ ਕਲਾਸਸ ਸਕੂਲ ਦੀਆਂ ਪੂਰੀਆਂ ਹੋਣਗੀਆਂ ਉਹ ਆਪਣੇ ਬੱਚਤ ਖਾਤੇ ਵਿੱਚ ਥੋੜ੍ਹਾ ਬਹੁਤਾ ਪੈਸਾ ਜਮ੍ਹਾਂ ਕਰਵਾ ਸਕਦਾ ਹੈ ਕਰ ਸਕਦਾ ਹੈ ਜੋ ਕਿ ਉਸਦੀ ਕਾਲਜ ਜਾਂ ਯੂਨੀਵਰਸਿਟੀ ਦੀ ਪੜ੍ਹਾਈ ਲਈ ਥੋੜ੍ਹਾ ਬਹੁਤਾ ਉਹਦੇ ਲਈ ਮਦਦਗਾਰ ਸਾਬਿਤ ਹੋ ਸਕਦਾ ਹੈ ਬਚਤ ਖਾਤੇ ਨਾਲ ਇੱਕ ਤਾਂ ਬੱਚੇ ਨੂੰ ਪੈਸੇ ਦੀ ਅਹਿਮੀਅਤ ਦਾ ਪਤਾ ਲੱਗਦਾ ਹੈ ਅਤੇ ਇੱਕ ਉਹ ਆਪਣੇ ਫਾਲਤੂ ਖਰਚੇ ਕਰਨ ਤੋਂ ਗੁਰੇਜ ਕਰੂਗਾ ਅਤੇ ਜਿਸ ਨਾਲ ਉਹਨੂੰ ਫਾਲਤੂ ਖਰਚੇ ਕਰਨ ਦੇ ਨੁਕਸਾਨ ਵੀ ਪਤਾ ਲੱਗਣਗੇ ਤਾਂ ਉਸ ਹਿਸਾਬ ਨਾਲ ਬੱਚਿਆਂ ਨੂੰ ਆਪਣਾ ਬੱਚਤ ਖਾਤਾ ਬਣਾਉਣ ਲਈ ਉਤਸ਼ਾਹਿਤ ਕਰਨ ਦੀ ਜ਼ਰੂਰਤ ਹੈ ਇਹ ਹਰ ਇੱਕ ਮਾਂ ਪਿਓ ਦੀ ਉਸ ਬੱਚੇ ਦੇ ਮਾਂ ਪਿਓ ਦੀ ਇੱਕ ਨੈਤਿਕ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ ਕਿ ਬੱਚਿਆਂ ਨੂੰ ਪੈਸੇ ਦੀ ਅਹਿਮੀਅਤ ਬਾਰੇ ਦੱਸਿਆ ਜਾਵੇ ਉਹਨਾਂ ਨੂੰ ਇਹ ਦੱਸਿਆ ਜਾਵੇ ਕਿ ਪੈਸਾ ਕਿਵੇਂ ਕਮਾਇਆ ਜਾਂਦਾ ਅਤੇ ਪੈਸੇ ਨੂੰ ਕਿਵੇਂ ਜੋੜਿਆ ਜਾ ਸਕਦਾ ਹੈ ਅਤੇ ਫਾਲਤੂ ਖਰਚਿਆਂ ਤੋਂ ਕਿਵੇਂ ਗੁਰੇਜ਼ ਕੀਤਾ ਜਾ ਸਕਦਾ ਹੈ ਫਾਲਤੂ ਖਰਚੇ ਜਿੰਨੇ ਘਟਣਗੇ ਉਹਨਾਂ ਦੇ ਉੰਨੇ ਉਹਨਾਂ ਦੀ ਪੜ੍ਹਾਈ ਲਈ ਵਧੀਆ ਸਾਬਿਤ ਹੋ ਸਕਦੇ ਆ ਕਿ ਉਹ ਆਪਣੀ ਅਗਲੇਰੀ ਵੱਡੀ ਪੜ੍ਹਾਈ ਲਈ ਕੁਛ ਪੈਸੇ ਜਮ੍ਹਾਂ ਕਰਵਾ ਸਕਦੇ ਆ ਤਾਂ ਉਸ ਹਿਸਾਬ ਨਾਲ ਬੱਚਿਆਂ ਨੂੰ ਆਪਣਾ ਬੱਚਤ ਖਾਤਾ ਬਣਾਉਣ ਲਈ ਉਹਨਾਂ ਦੇ ਮਾਂ ਪਿਓ ਨੂੰ ਚਾਹੀਦਾ ਕਿ ਇਹ ਉਹਨਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਅਤੇ ਇਸ ਨਾਲ ਬਚਤ ਖਾਤੇ ਬਣਵਾਉਣ ਨਾਲ ਬੱਚਿਆਂ ਨੂੰ ਕੀ ਫਾਇਦੇ ਹੋ ਸਕਦੇ ਇਹ ਵੀ ਉਹਨਾਂ ਦੇ ਮਾਂ ਪਿਓ ਨੂੰ ਮਾਤਾ ਪਿਤਾ ਨੂੰ ਬੱਚਿਆਂ ਨੂੰ ਸਮਝਾਉਣਾ ਚਾਹੀਦਾ ਹੈ ਅਤੇ ਉਹਨਾਂ ਦੇ ਜੋ ਫਾਇਦੇ ਬਚਤ ਖਾਤੇ ਦੇ ਫਾਇਦੇ ਅਤੇ ਜੇ ਉਹ ਫਾਲਤੂ ਖਰਚਾ ਕਰਦੇ ਹੈ ਉਹਨਾਂ ਦੇ ਕੀ ਨੁਕਸਾਨ ਹੋ ਸਕਦੇ ਆ ਜਾਂ ਹੁੰਦੇ ਹੈ ਉਹ ਬੱਚਿਆਂ ਦੇ ਮਾਂ ਪਿਓ ਨੂੰ ਉਹਨਾਂ ਨੂੰ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਇਹਨਾ ਗੱਲਾਂ ਬਾਰੇ ਸੁਚੇਤ ਕਰਨ ਅਤੇ ਹਰ ਰੋਜ਼ ਉਹਨਾਂ ਦੀ ਇਹਨਾਂ ਚੀਜ਼ਾਂ ਲਈ ਪ੍ਰੈਕਟਿਸ ਕਰਵਾਉਣ ਅਭਿਆਸ ਕਰਵਾਉਣ ਤਾਂ ਜੋ ਉਹ ਆਪਣੇ ਭਵਿੱਖ ਨੂੰ ਅੱਛਾ ਬਣਾ ਸਕਣ ਅਤੇ ਉਹ ਇਹੋ ਜਿਹੀ ਜਾਣਕਾਰੀ ਅੱਗੇ ਵੀ ਹਰ ਇੱਕ ਬੱਚੇ ਨੂੰ ਦਿੰਦੇ ਰਹਿਣ